ਮੇਰਾ ਮਨਪਸੰਦ ਲੇਖਕ ਹੈ ਉਹ ਨਰਿੰਦਰ ਸਿੰਘ ਕਪੂਰ ਹੈ ਅਤੇ ਉਨ੍ਹਾਂ ਦੀਆਂ ਕੁਝ ਕੁ ਕਿਤਾਬਾਂ ਜਿਵੇਂ ਕਿ ਮਾਲਾ ਮਣਕੇ ਅਤੇ ਤਰਕਵੇਦ ਅਤੇ ਖਿੜਕੀਆਂ ਜਿਹੜੀਆਂ ਮੈਨੂੰ ਜ਼ਿਆਦਾ ਮਤਲਬ ਇਹ ਕਿਤਾਬਾਂ ਪਸੰਦ ਹੈ ਅਤੇ ਉਹਨਾਂ ਦੁਆਰਾ ਜਿਹੜੀ ਲਿਖਤ ਆ ਉਹ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਜਿਹੜੀ ਭਾਸ਼ਾ ਦੇ ਵਿੱਚ ਲਿਖੀ ਜਾਂਦੀ ਹੈ ਜਿਹਨੂੰ ਕਿ ਇੱਕ ਸਧਾਰਨ ਵਿਅਕਤੀ ਵੀ ਜੋ ਪੜ੍ਹ ਸਕਦਾ ਆ ਕਈ ਵਾਰ ਕੁਝ ਲੇਖਕਾਂ ਨੇ ਇਹੋ ਜਿਹੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਜਿਹੜਾ ਕਿ ਆਮ ਵਿਅਕਤੀ ਦੀ ਸਮਝ ਤੋਂ ਬਾਹਰ ਹੁੰਦੀਆਂ ਆ ਅਤੇ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀਆਂ ਗਈਆਂ ਜਿਹੜੀ ਕਿਤਾਬਾਂ ਆ ਉਹਨਾਂ ਵਿੱਚ ਜਿਹੜੀ ਸਰਲ ਭਾਸ਼ਾ ਵਰਤੀ ਗਈ ਹੈ ਅਤੇ ਜੋ ਸ਼ਬਦ ਆ ਉਹ ਬਿਲਕੁਲ ਸ਼ੁੱਧ ਵਰਤੇ ਗਏ ਆ ਜਿਹਨੂੰ ਕਿ ਆਮ ਵਿਅਕਤੀ ਵੀ ਪੜ੍ਹ ਕੇ ਸਮਝ ਸਕਦਾ ਆ ਅਤੇ ਇੱਕ ਵਿਅਕਤੀ ਵਜੋਂ ਮੈਨੂੰ ਉਨ੍ਹਾਂ ਦੀ ਜੋ ਪਰਸਨੈਲਿਟੀ ਆ ਉਹ ਬਹੁਤ ਵਧੀਆ ਲੱਗਦੀ ਆ ਅਤੇ ਉਹਨਾਂ ਨੇ ਜੋ ਫਿਲੋਸਫਰ ਹੈ ਉਹ ਬਹੁਤ ਵਧੀਆ ਫਿਲੋਸਫਰ ਨੇ ਅਤੇ ਜੋ ਉਹਨਾਂ ਦੁਆਰਾ ਪੰਜਾਬੀ ਦੀਆਂ ਕਿਤਾਬਾਂ ਲਿਖੀਆਂ ਗਈਆਂ ਆ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਅਤੇ ਮੈਨੂੰ ਉਹ ਪੜ੍ਹਨ ਵਿੱਚ ਸਿੰਪਲ ਲੱਗਦੀਆਂ ਅਤੇ ਮੈਨੂੰ ਪੜ੍ਹ ਕੇ ਉਹਨਾਂ ਨੂੰ ਸਮਝ ਵੀ ਆਉਂਦੀ ਆ ਅਤੇ ਇਸ ਕਰਕੇ ਮੈਨੂੰ ਉਹ ਵਾਲੇ ਲੇਖਕ ਜ਼ਿਆਦਾ ਪਸੰਦ ਨੇ